ਏ ਹਈ ਇੱਕ ਕੰਪਿਊਟਰ ਐਪ ਹੈ ਜੋ ਕਿ ਨਵੀਂ ਆਈ ਹੈ ਇਸ ਰਾਹੀਂ ਅਸੀਂ ਆਪਣੀ ਸਮੱਸਿਆ ਦਾ ਹੱਲ ਪੁੱਛ ਸਕਦੇ ਹਾਂ ਅਗਰ ਸਾਨੂੰ ਸਮੱਸਿਆ ਦਾ ਕੋਈ ਵੀ ਹੱਲ ਚਾਹੀਦਾ ਹੈ ਤਾਂ ਅਸੀਂ ਏ ਆਈ ਵਿੱਚ ਬੋਲ ਸਕਦੇ ਹਾਂ ਅਤੇ ਉਹ ਸਾਡੀ ਸਮੱਸਿਆ ਦਾ ਹੱਲ ਕਰ ਦਿੰਦਾ ਹੈ ਇਸ ਕਰਕੇ ਇਸ ਦੇ ਬਹੁਤ ਹੀ ਫਾਇਦੇ ਹਨ ਪਰ ਇਸ ਦੇ ਬਹੁਤ ਹੀ ਨੁਕਸਾਨ ਵੀ ਹਨ ਅਗਰ ਇਹ ਸਾਡਾ ਹੱਲ ਨਾ ਕਰ ਪਾਏ ਤਾਂ ਉਸ ਸਥਿਤੀ ਵਿੱਚ ਇਹ ਰਚਨਾਤਮਕ ਬਣ ਜਾਂਦਾ ਹੈ ਅਗਰ ਇਹ ਏ ਆਈ ਐਪ ਲੋਕਾਂ ਦੀ ਸਮੱਸਿਆ ਦਾ ਹੱਲ ਨਾ ਕਰ ਪਾਏ ਤਾਂ ਇਹ ਉਸ ਸਥਿਤੀ ਵਿੱਚ ਰਚਨਾਤਮਕ ਗਵਾ ਰਿਹਾ ਹੈ ਧੰਨਵਾਦ